ਮੈਂ ਸਵੇਰੇ ਜਾਂ ਸ਼ਾਮ ਹਰ ਰੋਜ਼ ਦੋੜਨ ਜਾਂਦਾ ਕਿਉਂਕਿ ਇਸ ਨਾਲ ਮੈਨੂੰ ਬਹੁਤ ਹੀ ਜ਼ਿਆਦਾ ਸੀ ਇੱਕ ਗਤੀਵਿਧੀ ਮਹਿਸੂਸ ਹੁੰਦੀ ਹੈ ਅਤੇ ਮੈਨੂੰ ਹਰ ਰੋਜ਼ ਥਕਾਵਟ ਮਹਿਸੂਸ ਨਹੀਂ ਹੁੰਦੀ ਜਿਸ ਨਾਲ ਮੈਂ ਤੰਦਰੁਸਤ ਰਹਿੰਦਾ ਅਤੇ ਫਿੱਟ ਰਹਿੰਦਾ ਇਸਦਾ ਮੇਨ ਕਾਰਨ ਹੈ ਕਿ ਮੈਨੂੰ ਹਰ ਰੋਜ਼ ਵਧੀਆ ਮਹਿਸੂਸ ਹੁੰਦਾ ਅਤੇ ਮੈਨੂੰ ਥਕਾਵਟ ਨਹੀਂ ਹੁੰਦੀ ਇਸ ਨਾਲ ਐਂਡਰੋਫਇਨ ਨਾਲ ਦੌੜਨ ਨਾਲ ਸਰੀਰ ਐਂਡਰੋਫਇਨ ਜ਼ਾਰੀ ਕਰਦਾ ਜੋ ਖੁਸ਼ੀ ਅਤੇ ਆਰਾਮ ਦੇ ਅਨੁਭਵਾਂ ਨੂੰ ਵਧਾਉਂਦਾ ਹੈ ਤਨਾਅ ਵਿੱਚ ਘਟਾਅ ਜਦੋਂ ਅਸੀਂ ਦੌੜਦੇ ਹਾਂ ਤਾਂ ਇਹ ਸਾਡੇ ਮਨ ਨੂੰ ਸ਼ਾਂਤ ਕਰਨ ਵਿੱਚ ਮਦਦ ਕਰਦਾ ਹੈ ਤਨਾਅ ਦੇ ਲੱਛਣ ਘਟਾਉਂਦਾ ਹੈ ਦੌੜਨ ਨਾਲ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਵੱਧਦੀ ਹੈ ਜਿਸ ਨਾਲ ਮਨ ਸ਼ਾਂਤ ਅਤੇ ਫੋਕਸ ਬਣਾਉਣ ਵਿੱਚ ਮਦਦ ਮਿਲਦੀ ਹੈ ਊਰਜਾ ਦੀ ਗ ਗਤੀ ਜਾਂ ਵਾਧਾ ਜਦੋਂ ਅਸੀਂ ਰੋਜ਼ ਸਵੇਰੇ ਸ਼ਾਮ ਨਿਯਮਿਤ ਦੌੜਦੇ ਹਾਂ ਤਾਂ ਸਾਡੀ ਸਰੀਰ ਦੀ ਊਰਜਾ ਵੱਧਦੀ ਹੈ ਜਿਸ ਨਾਲ ਦਿਨ ਦੀਆਂ ਕਿਰਿਆਵਾਂ ਵਿੱਚ ਜ਼ਿਆਦਾ ਉਤਸਾਹ ਮਹਿਸੂਸ ਹੁੰਦਾ ਹੈ ਆਤਮ ਵਿਸ਼ਵਾਸ ਜਦੋਂ ਮੈਂ ਹਰ ਰੋਜ਼ ਦੌੜਨ ਜਾਂਦਾ ਹਾਂ ਤਾਂ ਨਤੀਜੇ ਵਜੋਂ ਸਾ ਮੇਰੇ ਉੱਦਮ ਵਿੱਚ ਵਿਕਾਸ ਅਤੇ ਆਤਮ ਵਿਸ਼ਵਾਸ ਵੱਧਦਾ ਹੈ ਇਸ ਤਰ੍ਹਾਂ ਦੌੜਨ ਦੇ ਨਾਲ ਮੇਰਾ ਅਰਾਮ ਅਤੇ ਤੰਦਰੁਸਤੀ ਦਾ ਅਨੁਭਵ ਵਧੀਆ ਹੁੰਦਾ ਹੈ ਮੈਨੂੰ ਰੋਜ਼ ਦੌੜਨ ਲਈ ਮੇਰਾ ਦੋਸਤ ਗਰੇਜ਼ ਕਰਦਾ ਜਿਸ ਨਾਲ ਮੈਂ ਹਰ ਉੱਠਦਾ ਬੈਠਦਾ ਉਹ ਮੈਨੂੰ ਦੱਸਦਾ ਕਿ ਦੌੜਨ ਦੇ ਕਿੰਨੇ ਜ਼ਿਆਦਾ ਫਾਇਦੇ ਹਨ ਇਸ ਨਾਲ ਸਾਡਾ ਸਰੀਰ ਫਿਟ ਰਹਿੰਦਾ ਅਤੇ ਅਸੀਂ ਵਧੀਆ ਮਹਿਸੂਸ ਕਰਦੇ ਆ ਅਤੇ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗਦੀ ਅਤੇ ਸਾਡਾ ਖੁਸ਼ੀ ਗਮੀ ਆਦਿ ਵਿੱਚ ਵਧੀਆ ਸਰੀਰ ਰਹਿੰਦਾ ਅਤੇ ਸਾਨੂੰ ਹਰ ਇੱਕ ਨਾਲ ਵਧੀਆ ਨੇਚਰ ਅਤੇ ਵਧੀਆ ਸੁਭਾਅ ਹੁੰਦਾ ਅਤੇ ਸਾਡੀ ਚਿਹਰੇ ਵਿੱਚ ਹੀ ਨਵੀਂ ਰੌਣਕ ਮਹਿਸੂਸ ਹੁੰਦੀ ਹੈ ਜਿਸ ਕਾਰਨ ਮੈਂ ਸਵੇਰੇ ਸ਼ਾਮ ਹਰ ਰੋਜ਼ ਦੌੜਨ ਜਾਂਦਾ ਹਾਂ ਅਤੇ ਦੌੜਦੇ ਹੋਏ ਮੈਂ ਲਗਭਗ ਅੱਧਾ ਪੌਣਾ ਘੰਟਾ ਭੱਜਦਾ ਹਾਂ ਜਿਸ ਨਾਲ ਮੇਰੇ ਸਰੀਰ ਨੂੰ ਵਧੀਆ ਥਕਾਵਟ ਮਹਿਸੂਸ ਹੁੰਦੀ ਜਿਸ ਨਾਲ ਮੈਂ ਸਾਰਾ ਦਿਨ ਚੁਸਤ ਫੁਸਤ ਦਰੁਸਤ ਰਹਿੰਦਾ ਅਤੇ ਮੈਨੂੰ ਕੋਈ ਬਿਮਾਰੀ ਨਹੀਂ ਹੁੰਦੀ ਅਤੇ ਮੈਂ ਹਰ ਰੋਜ਼ ਸਵੇਰੇ ਪੰਜ ਵਜੇ ਜਾਂਦਾ ਆ ਅਤੇ ਛੇ ਵਜੇ ਤੱਕ ਐਕਸ ਉਕਸਸਾਈਜ਼ ਅਤੇ ਵਧੀਆ ਤਰੀਕੇ ਭਾਲਦਾ ਹੈ ਇਸਦਾ ਮੇਨ ਕਾਰਨ ਮੈਂ ਆਪਦੇ ਦੋ ਦੋਸਤ ਦੇ ਨਾਲ ਕਿਉਂਕਿ ਉਹ ਮੈਨੂੰ ਪ੍ਰੇਰਿਤ ਕਰਦਾ ਕਿ ਭੱਜ ਹੋਰ ਭੱਜ ਹੋਰ ਭੱਜ ਇਹੀ ਮੇਨ ਕਾਰਨ ਹੈ ਕਿ ਮੈਂ ਹਰ ਰੋਜ਼ ਸਵੇਰੇ ਉੱਠਦੇ ਨਾਲ ਦੌੜਨ ਜਾਂਦਾ ਅਤੇ ਸਮਾਂ ਬਤੀਤ ਕਰਦਾ ਅਤੇ ਮੈਂ ਹਰ ਇੱਕ ਨੂੰ ਕਹਾਂਗਾ ਕਿ ਸਵੇਰੇ ਸ਼ਾਮ ਭੱਜਣਾ ਚਾਹੀਦਾ ਹੈ